ਹੈਲੋ ਹਾਂਜੀ ਸਰ ਪਾਸਪੋਰਟ ਔਫਿਸ ਤੋਂ ਗੱਲ ਕਰ ਰਹੇ ਹੋ ਵੀ ਹਾਂਜੀ ਸਰ ਮੈਨੇ ਆਪਣਾ ਪਾਸਪੋਰਟ ਅਪਡੇਟ ਕਰਵਾਉਣਾ ਹੈ ਜੀ ਜਿਹੜਾ ਮੇਰਾ ਉਪਨਾਮ ਸੀਗਾ ਮੈਨੂੰ ਉਹ ਉਪਨਾਮ ਚੇਂਜ ਕਰਵਾਉਣਾ ਹੈ ਜੀ ਅਤੇ ਉਹ ਜਿਹੜਾ ਉਪਨਾਮ ਚੇਂਜ ਕਰਵਾਉਣਾ ਹੈ ਮੇਰੇ ਵਿਆਹ ਤੋਂ ਬਾਅਦ ਵਾਲਾ ਨਾਮ ਮੈਨੇ ਕਰਵਾਉਣਾ ਹੈ ਜੀ ਅਤੇ ਉਸ ਤੋਂ ਬਾਅਦ ਮੈਨੂੰ ਕੀ ਚੀਜ਼ ਦੀ ਜ਼ਰੂਰਤ ਪਵੇਗੀ ਕੋਈ ਐਫੀਡੈਪਟ ਲੱਗੇਗਾ ਕੋਈ ਪਰੂਫ ਲੱਗੇਗਾ ਉਹਦੇ ਬਾਰੇ ਮੈਨੂੰ ਤੁਸੀਂ ਦੱਸੋ ਜੀ ਵੀ ਜਿਹੜੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਪਵੇਗੀ ਉਹ ਮੈਂ ਤੁਹਾਨੂੰ ਦੱਸੂ ਕਿੰਨੀਆਂ ਫੋਟੋਆਂ ਚਾਹੀਦੀਆਂ ਨੇ ਕਿਹੜੇ ਸਰਟੀਫਿਕੇਟ ਲੱਗੇਗਾ ਕਿ ਆਧਾਰ ਕਾਰਡ ਲੱਗੇਗਾ ਆਪਣਾ ਪੈਨ ਕਾਰਡ ਲੱਗੇਗਾ ਜੋ ਵੀ ਲੱਗੇਗਾ ਮੈਨੂੰ ਦੱਸੋ ਜੀ ਅਤੇ ਉਹ ਫਿਰ ਮੈਂ ਆਪਣਾ ਨਾਮ ਅਪਡੇਟ ਕਰਵਾ ਕੇ ਆਪਣਾ ਪਾਸਪੋਰਟ ਅਪਡੇਟ ਕਰਵਾਉਣਾ ਜੀ